ਹਾਂਜੀ ਮੈਡਮ ਇਡਲੀ ਬਣਾਉਣ ਲਈ ਨਾ ਆਪਾਂ ਇਸ ਤਰਾਂ ਕਰੋ ਜਿਵੇਂ ਇੱਕ ਕੌਲੀ ਆਪਾਂ ਸੂਜੀ ਲੈ ਲਈ ਉਹਦੇ ਵਿੱਚ ਅੱਧਾ ਕਿਲੋ ਦਹੀਂ ਮਿਕਸ ਕਰ ਦਹੀਂ ਪਾ ਕੇ ਉਹਨੂੰ ਫੈਂਟ ਲਉ ਚੰਗੀ ਤਰ੍ਹਾਂ ਜਦੋਂ ਚੰਗੀ ਤਰ੍ਹਾਂ ਫੈਂਟ ਰਹੇ ਇਹਨੂੰ ਢੱਕ ਕੇ ਰੱਖ ਦਿਉ ਅਤੇ ਢੱਕ ਕੇ ਇਹਨੂੰ ਪੰਦਰਾਂ ਵੀਹ ਮਿੰਟ ਪਈ ਰਹਿਣ ਦਿਉ ਉਦੋਂ ਬਾਅਦ ਥੋੜ੍ਹੀ ਜਿਹੀ ਰਾਈ ਭੁੰਨ ਲਓ ਇੱਕ ਪਾਸੇ ਰਾਈ ਭੁੰਨ ਕੇ ਘਿਓ ਦੇ ਵਿੱਚ ਇਹਨੂੰ ਜਿਹੜਾ ਆਪਾਂ ਇਡਲੀ ਲਈ ਬਣਾਇਆ ਸੀਗਾ ਉਹਦੇ ਵਿੱਚ ਪਾ ਦਿਉ ਇਹਨੂੰ ਇਹਨੂੰ ਫਿਰ ਚੰਗੀ ਤਰ੍ਹਾਂ ਫੈਂਟ ਲਓ ਫੈਂਟ ਕੇ ਇਹਦੇ ਵਿੱਚ ਥੋੜ੍ਹਾ ਜਿਹਾ ਲੂਣ ਪਾ ਦੋ ਕੜੀ ਪੱਤਾ ਭੁੰਨ ਕੇ ਪਾ ਦਿਉ ਇਹ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰਾਂ ਫੈਂਟ ਲਉ ਫਿਰ ਇੱਕ ਪਾਸੇ ਤੁਸੀਂ ਗੈਸ 'ਤੇ ਇਡਲੀ ਬਣਾਉਣ ਵਾਲਾ ਬਰਤਨ ਰੱਖੋ ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਲਉ ਜਦੋਂ ਪਾਣੀ ਉਬਲਣਾ ਸ਼ੁਰੂ ਹੋ ਜਾਏ ਦੂਜੇ ਪਾਸੇ ਜੋ ਤੁਸੀਂ ਬੈਟਰ ਬਣਾਇਆ ਸੀਗਾ ਉਹ ਬੈਟਰ ਦੇ ਵਿੱਚ ਤੁਸੀਂ ਈਨੋ ਪਾਊਡਰ ਪਾ ਲਉ ਇਨੋ ਪਾਊਡਰ ਜਿਸ ਤਰ੍ਹਾਂ ਕਿ ਆਪਾਂ ਇੱਕ ਕੋਲੀ ਸੂਜੀ ਪਾਈ ਹੈ ਇਡਲੀ ਵਾਸਤੇ ਉਹਦੇ ਵਿੱਚ ਅੱਧਾ ਚਮਚ ਇਨੋ ਪਾਊਡਰ ਪੈ ਜੂਗਾ ਇਨੋ ਪਾਊਡਰ ਪਾ ਕੇ ਉਹਨੂੰ ਚੰਗੀ ਤਰਾਂ ਫੈਂਟ ਲਉ ਚੰਗੀ ਤਰ੍ਹਾਂ ਫੈਂਟ ਕੇ ਇੰਨੇ 'ਚ ਦੇਖੋ ਉੱਧਰ ਪਾਣੀ ਉਬਲਣਾ ਸ਼ੁਰੂ ਹੋ ਗਿਆ ਹੋਊਗਾ ਉਹਦੇ 'ਚ ਭਾਫ਼ ਨਿਕਲਣੀ ਸ਼ੁਰੂ ਹੋ ਗਈ ਹੋਊਗੀ ਉਹਦੀਆਂ ਜਿਵੇਂ ਕਿ ਦੋ ਟਰੇਆਂ ਨੇ ਉਹ ਟਰੇਆਂ 'ਚ ਘਿਓ ਦਾ ਹੱਥ ਲਾ ਕੇ ਉਹ ਬੈਟਰ ਉਹਦੇ ਵਿੱਚ ਪਾ ਕੇ ਢੱਕ ਦਿਉ ਢੱਕ ਕੇ ਫਿਰ ਇਹਨੂੰ ਭਾਫ਼ ਆਉਣ ਦਿਉ ਇਹਦਾ ਤਕਰੀਬਨ ਕੋਈ ਸੱਤ ਮਿੰਟ ਲੱਗਦੇ ਆ ਇੱਕ ਵਾਰੀ ਇਹਨੂੰ ਪੱਕਣ 'ਤੇ ਅਤੇ ਇਹ ਜਦੋਂ ਪੱਕ ਜੂਗੀ ਇਹਨੂੰ ਥੋੜ੍ਹੇ ਠੰਡੀ ਹੋਣ ਦਿਉ ਅਤੇ ਠੰਡੀ ਹੋ ਕੇ ਕੱਢ ਲਉ